ਭਾਰਤ ਵਿੱਚ ਬੋਲੀਵੁੱਡ ਅਤੇ ਡਾਂਸਰਾਂ ਦਾ ਵੱਡਾ ਪ੍ਰਭਾਵ ਹੈ ਬੋਲੀਵੁੱਡ ਹਰੇਕ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਲੋਕ ਬੋਲੀਵੁੱਡ ਦੇ ਅਭਿਨੇਤਾ ਅਤੇ ਅਭਿਨੇਤਰੀਆਂ ਨੂੰ ਆਪਣਾ ਮਾਰਗਦਰਸ਼ਕ ਮੰਨਦੇ ਹਨ ਭਾਰਤ ਅਤੇ ਪੰਜਾਬ ਵਿੱਚ ਕੁਝ ਅਜਿਹੇ ਗਾਣੇ ਹਨ ਜੋ ਕਿ ਹਰੇਕ ਵਰਗ ਦੇ ਲੋਕਾਂ ਨੂੰ ਬਹੁਤ ਪਸੰਦ ਹਨ ਜਿਨ੍ਹਾਂ ਵਿੱਚੋਂ ਲਤਾ ਮੰਗੇਸ਼ਕਰ ਦਾ ਸੈਨੋਰੀਡਾ ਗਾਨਾ ਛੋਲੇ ਫਿਲਮ ਦਾ ਯੇਹ ਦੋਸਤੀ ਅਤੇ ਹੁਣੇ ਹੀ ਰਿਲੀਜ਼ ਹੋਇਆ ਪੁਰਾਣਾ ਪੰਜਾਬੀ ਸੌਂਗ ਜਿਸ ਨੂੰ ਕਿ ਬੱਬਲਪ੍ਰੀਤ ਸਿੰਘ ਨੇ ਗਾਇਆ ਹੈ ਜਿਸ ਦਾ ਨਾਮ ਅਰਜਨ ਵੈਲੀ ਹੈ ਇਹ ਗਾਣਾ ਵੀ ਅੱਜ ਹਰੇਕ ਵਰਗ ਦੇ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ ਇਸ ਤਰ੍ਹਾਂ ਭਾਰਤ ਵਿੱਚ ਡਾਂਸਰਾਂ ਅਤੇ ਬੋਲੀਵੁੱਡ ਦਾ ਬਹੁਤ ਜ਼ਿਆਦਾ ਵੱਡਾ ਪ੍ਰਭਾਵ ਹੈ